ਪਿਛਲੇ ਕੁਝ ਸਮੇਂ ਤੋਂ ਕੁਝ ਵੱਡੀਆਂ ਟੈਕਨੋਲਜੀ ਤਬਦੀਲੀਆਂ ਆਈਆਂ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਮੋਬਾਇਲ ਫ਼ੋਨ ਅੱਗੇ ਲੋਕ ਚਿੱਠੀਆਂ ਪਾਉਂਦੇ ਹੁੰਦੇ ਸੀ ਅੱਜ ਕੱਲ੍ਹ ਫੋਨ 'ਤੇ ਬੈਠੇ ਦੁਨੀਆਂ ਦੇ ਕਿਸੇ ਵੀ ਖੁੰਜੇ ਦੇ ਵਿੱਚ ਆਪਾਂ ਗੱਲਬਾਤ ਕਰ ਸਕਦੇ ਹਾਂ ਕੋਈ ਸੁਨੇਹਾ ਭੇਜਣਾ ਉਹ ਭੇਜ ਸਕਦੇ ਹਾਂ ਸੌਖੇ ਤਰੀਕੇ ਦੇ ਨਾਲ ਅਤੇ ਦੂਜਾ ਮਿੱਲਾਂ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਆ ਚੁੱਕੀਆਂ ਨੇ ਜਿਨਾਂ ਕਰਕੇ ਉੱਥੇ ਬੰਦਿਆਂ ਦੀ ਜ਼ਰੂਰਤ ਘਟ ਗਈ ਹੈ ਅਤੇ ਕੰਮ ਵਾਲੀ ਥਾਂ ਬਹੁਤ ਪ੍ਰਭਾਵਿਤ ਹੋਈ ਹੈ ਜਿੱਥੇ ਸੌ ਬੰਦੇ ਦਾ ਕੰਮ ਸੀ ਉਥੇ ਹੁਣ ਮਸ਼ੀਨਾਂ ਦੇ ਆਉਣ ਕਰਕੇ ਉਹ ਸਿਰਫ ਵੀਹ ਜਾਂ ਤੀਹ ਬੰਦਿਆਂ ਦਾ ਕੰਮ ਰਹਿ ਗਿਆ ਇਸ ਕਰਕੇ ਟੈਕਨੋਲਜੀ ਨੇ ਬਹੁਤ ਤਬਦੀਲੀ ਕੀਤੀ ਆ ਜ਼ਿਆਦਾਤਰ ਵਾਤਾਵਰਨ ਨੂੰ ਪ੍ਰਭਾਵਿਤ ਵੀ ਕੀਤਾ